ਹੈਲੋ ਹਾਂ ਹਾਂਜੀ ਸਰ ਗੁਰਲਾਲ ਸਰ ਬੋਲਦੇ ਹੋ ਪਾਸਪੋਰਟ ਔਫੀਸਰ ਹਾਂਜੀ ਸਰ ਮੈਂ ਅਮਨਜੋਤ ਕੌਰ ਬੋਲ ਰਹੀ ਹਾਂ ਮੁਕਤਸਰ ਸਾਹਿਬ ਤੋਂ ਹਾਂਜੀ ਸਰ ਮੈਨੂੰ ਮੇਰੀ ਫਰੈਂਡ ਨੇ ਦਿੱਤਾ ਸੀਗਾ ਤੁਹਾਡਾ ਫੋਨ ਨੰਬਰ ਰਜਨੀ ਨੇ ਹਾਂਜੀ ਅਤੇ ਸਰ ਮੇਰਾ ਨਾ ਐਕਚੁਲੀ ਮੈਂ ਪਾਸਪੋਰਟ ਅਪਲਾਈ ਕਰਨਾ ਸੀਗਾ ਹਾਂਜੀ ਸਰ ਅਤੇ ਮੁਕਤਸਰ ਦਾ ਜਿਹੜਾ ਸੇਵਾ ਕੇਂਦਰ ਹੈ ਸਰ ਉਹ ਮਤਲਬ ਕਿ ਕੋਈ ਰੀਜ਼ਨ ਕਰਕੇ ਮਤਲਬ ਕਿ ਅਵੇਲੇਬਲ ਨਹੀਂ ਹੈਗਾ ਹਾਂਜੀ ਸਰ ਅਤੇ ਸਰ ਮੈਨੂੰ ਤੁਸੀਂ ਦੱਸੋ ਮੈਂ ਕਿੱਥੇ ਅਪਲਾਈ ਕਰਾਂ ਆਪਣਾ ਪਾਸਪੋਰਟ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਤਤਕਾਲ ਦਾ ਮਤਲਬ ਜਿਵੇਂ ਆਪਾਂ ਜਲਦੀ ਮੰਗਵਾਉਣਾ ਮੈਨੂੰ ਐਮਰਜੰਸੀ ਚਾਹੀਦਾ ਨਾ ਪਾਸਪੋਰਟ ਅਤੇ ਮਤਲਬ ਉਹਦੇ ਵਿੱਚ ਮੈਨੂੰ ਤੁਸੀਂ ਦੱਸੋ ਤਤਕਾਲ ਦਾ ਪ੍ਰੋਸੈਸ ਮਤਲਬ ਉਹ 'ਚ ਕਿ ਐਕਸਟਰਾ ਚਾਰਜਸ ਵਗੈਰਾ ਜਾਂ ਕਿਵੇਂ ਕੀ ਸਿਸਟਮ ਹੈ ਹਾਂਜੀ ਸਰ ਡਾਕੂਮੈਂਟ ਥੋੜ੍ਹੇ ਐਕਸਟਰਾ ਲੱਗਦੇ ਹੈ ਮਤਲਬ ਹਾਂਜੀ ਓਕੇ ਅਤੇ ਸਰ ਸਿਟੀ ਕਿਹੜੀ ਮਤਲਬ ਕਿਹੜੀ ਕਿਹੜੀ ਸਿਟੀ 'ਚ ਅਵੇਲੇਬਲ ਆ ਠੀਕ ਹੈ ਸਰ ਸਰ ਮਤਲਬ ਜਿਵੇਂ ਹੁਣ ਅੰਮ੍ਰਿਤਸਰ ਮੇਰੇ ਨੋਨ ਹੈ ਹੈ ਨਾ ਅਤੇ ਮੈਂ ਉੱਥੋਂ ਅਪਲਾਈ ਕਰਨਾ ਹੋਵੇ ਤਾਂ ਮਤਲਬ ਕੋਈ ਇਸ਼ੂ ਤਾਂ ਨਹੀਂ ਆਉਗਾ ਨਾ ਜਿਵੇਂ ਡਿਸਟਰਿਕਟ ਡਿਸ ਡਿਫਰੈਂਟ ਹੋ ਗਿਆ ਜਾਂ ਜੋ

ਠੀਕ ਹੈ ਸਰ ਹਾਂਜੀ ਸਰ ਕੋਈ ਗੱਲ ਨਹੀਂ ਸਰ ਹਾਂਜੀ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ